ਹੈਲੋ ਮਾਵੀ ਟੈਕਸੀ ਸਟੈਂਡ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਥੇ ਮੋਹਾਲੀ ਤੋਂ ਬੋਲਦੈਂ ਅਸੀਂ ਨਾ ਆਪਣੇ ਪਿੰਡ ਜਾਣਾ ਏ ਸਾਨੂੰ ਕੋਈ ਜ਼ਰੂਰੀ ਹੈ ਸ਼ਾਦੀ ਦੇ ਵਿੱਚ ਸ਼ਾਮਿਲ ਹੋਣਾ ਪ ਪਿੱਪਲ ਮਾਜਰਾ ਚਮਕੌਰ ਸਾਹਿਬ ਦੇ ਨੇੜੇ ਹੀ ਅਤੇ ਮੈਨੂੰ ਟੈਕਸੀ ਚਾਹੀਦੀ ਹੈ ਜਿਹਦਾ ਏ ਸੀ ਵੀ ਕੰਮ ਕਰਦਾ ਹੋਵੇ ਅਸੀਂ ਜਾਣ ਵਾਲੇ ਹਾਂ ਮੈਂ ਅਤੇ ਮੇਰੀ ਮਿਸਿਜ ਮੇਰਾ ਬੇਟਾ ਅਤੇ ਮੇਰੀ ਡੋਟਰ ਇਨ ਲਾ ਅਤੇ ਮੇਰਾ ਗਰੈਂਡ ਸਨ ਅਤੇ ਸਾਨੂੰ ਕੋਈ ਰਾਸਤੇ 'ਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕੋਈ ਟੋਲ ਨਹੀਂ ਅਸੀਂ ਦੇਣਾ ਇਹ ਤੁਸੀਂ ਭਾਵੇਂ ਪਹਿਲਾਂ ਹੀ ਵਿੱਚ ਕਿਰਾਏ ਦੇ ਵਿੱਚ ਜੋ ਵੀ ਹੈ ਕਰ ਲਿਓ ਟੋਲ ਅਸੀਂ ਦੇਣਾ ਸਾਨੂੰ ਰਸਤੇ 'ਚ ਕੋਈ ਪ੍ਰੋਬਲਮ ਨਾ ਆਵੇ ਅਤੇ ਉੱਤੋਂ ਅਸੀਂ ਤਾਂ ਕਰਕੇ ਅਸੀਂ ਜਿਹੜਾ ਆਪਣੇ ਫੰਕਸ਼ਨ ਦੇ ਵਿੱਚ ਜਾਣਾ ਏ ਠੀਕ ਠਾਕ ਅਟੈਂਡ ਕਰ ਸਕੀਏ ਜੋ ਵੀ ਕਰਾਇਆ ਦੱਸੂਗੇ ਉਹਦੇ ਹਿਸਾਬ ਨਾਲ਼ ਮੈਨੂੰ ਤੁਸੀਂ ਦੱਸ ਦਿਓ ਆਪਾਂ ਨੂੰ ਸ਼ੂਟ ਕਰੇਗਾ ਤਾਂ ਕਰ ਲਵਾਂਗੇ ਨਹੀਂ ਫਿਰ ਤੁਹਾਡੇ ਕਿਸੇ ਹੋਰ ਨੂੰ ਰਿਕੁਐਸਟ ਕਰ ਲਵਾਂਗੇ ਧੰਨਵਾਦ